ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਤੁਸੀਂ ਦੱਸੋ ਕੌਣ ਬੋਲ ਹਾਂਜੀ ਹਾਂਜੀ ਹਾਂਜੀ ਬਹੁਤ ਸ਼ੋਪ ਹੈ ਸਨੇਟੇ ਚਲੇ ਜਾਓ ਥ੍ਰੀ ਵੀ ਟੂ ਦੀ ਮਾਰਕੀਟ ਹੈ ਖਰੜ ਪੰਜਾਬੀ ਜੁੱਤੀ ਦੀ ਬਹੁਤ ਸ਼ੋਪਸ ਹੈ ਨੇੜੇ ਤਾਂ ਸਨੇਟਾ ਹੀ ਪੈਂਦਾ ਵੈਸੇ ਤਾਂ ਖੈੜ ਵੀ ਐਨੀ ਦੂਰ ਨਹੀਂ ਹੈ ਖੈੜ ਵੀ ਜਾ ਸਕਦੇ ਹੋ ਤੁਸੀਂ ਬਟ ਉਹ ਥੋੜ੍ਹਾ ਮਹਿੰਗਾ ਮਤਲਬ ਖੈੜ ਦੀ ਮਾਰਕੀਟ ਮਹਿੰਗੀ ਪੈ ਜਾਂਦੀ ਹੈ ਤਾਂ ਸਨੇਟੇ ਠੀਕ ਰੇਟ ਹੈ ਸਨੇਟੇ ਪਰ ਦੇਖ ਲਉ ਤੁਸੀਂ ਹਾਂਜੀ ਸਭ ਕੁਛ ਮਿਲ ਜੂਗਾ ਪੰਜਾਬੀ ਸੂਟ ਜੁੱਤੀ ਜਵੈਲਰੀ ਦੁਪੱਟੇ ਮਤਲਬ ਜੋ ਵੀ ਤੁਹਾਨੂੰ ਚਾਹੀਦਾ ਪੂਰੀ ਫੁੱਲ ਮਾਰਕੀਟ ਹੈ ਖਾਣੇ ਪੀਣੇ ਦਾ ਵੀ ਸਭ ਕੁਛ ਮਿਲ ਜੂਗਾ ਉੱਥੇ ਅਲੱਗ ਵੀ ਮਿਲ ਜਾਂਦੀ ਹੈ ਅਗਰ ਤੁਸੀਂ ਨਾਲ ਮੈਚਿੰਗ ਲੈਣੀ ਹੈ ਤਾਂ ਮੈਚਿੰਗ ਵੀ ਲੈ ਸਕਦੇ ਹੋ ਉਹ ਤੁਹਾਡੀ ਚੋਇਸ ਹੈ ਹਾਂਜੀ ਹਾਂਜੀ ਰੈਂਟ ਵਾਲੀਆਂ ਅਲੱਗ ਹਾਂ ਰੈਂਟ ਵਾਲੀਆਂ ਅਲੱਗ ਸ਼ੋਪ ਹੈਗੀਆਂ ਕਈ ਸ਼ੋਪ ਹੈਗੀਆਂ ਜੋ ਰੈਂਟ ਖਰੜ ਹੈ ਰੈਂਟ ਰੈਂਟ 'ਤੇ ਜਿੱਥੋਂ ਸਭ ਕੁਛ ਮਿਲ ਜਾਂਦਾ ਲਹਿੰਗੇ ਸੂਟ ਸਾੜੀ ਜੋ ਵੀ ਤੁਸੀਂ ਲੈਣਾ ਤਾਂ ਤੁਸੀਂ ਉੱਥੇ ਤੋਂ ਦੇਖ ਸਕਦੇ ਹੋ ਔਰ ਜਵੈਲਰੀ ਵੀ ਨਾਲ ਦਿੰਦੇ ਨੇ ਬਸ ਜੁੱਤੀ ਤਾਂ ਆਪਣੀ ਅਲੱਗ ਤੋਂ ਹੀ ਲੈਣੀ ਪਊਗੀ ਹਾਂਜੀ ਬਜਟ 'ਚ ਮਿਲ ਜੂਗਾ ਉਹ ਆਪਣੀ ਚੋਇਸ 'ਤੇ ਆ ਵੀ ਤੁਸੀਂ ਹੈਵੀ ਲੈਣਾ ਜਾਂ ਮਤਲਬ ਹਲਕਾ ਲੈਣਾ ਉਸ ਤਰ੍ਹਾਂ ਹੀ ਬਜਟ 'ਤੇ ਮਿਲ ਜੂਗਾ ਆਪਣੇ ਬਜਟ ਦੇ ਅਕੋਡਿੰਗ ਹਾਂਜੀ ਠੀਕ ਹੈ ਤੁਸੀਂ ਆਪ ਜਾ ਕੇ ਪਤਾ ਕਰ ਲਉ ਦੇਖ ਲਉ ਓਕੇ ਜੀ ਥੈਂਕ ਯੂ